ਜੇਕਰ ਆਪਾਂ ਪੁਰਾਣੀ ਪੀੜ੍ਹੀ ਅਤੇ ਨੌਜਵਾਨ ਪੀੜ੍ਹੀ ਦੀ ਗੱਲ ਕਰੀਏ ਤਾਂ ਪੁਰਾਣੀ ਪੀੜ੍ਹੀ ਤੋਂ ਨੌਜਵਾਨ ਪੀੜ੍ਹੀ ਤੱਕ ਬਹੁਤ ਬਦਲਾਵ ਆਏ ਹਨ ਪਹਿਲਾਂ ਲੋਕ ਘਰ ਦਾ ਖਾਣਾ ਖਾਂਦੇ ਸਨ ਉਨ੍ਹਾਂ ਦੀ ਸਿਹਤ ਬਹੁਤ ਠੀਕ ਰਹਿੰਦੀ ਸੀ ਉਹ ਸੈਰ ਲਈ ਜਾਂਦੇ ਸੀ ਤਕੜੇ ਸੀ ਅਤੇ ਉਨ੍ਹਾਂ ਦੀ ਉਮਰਾਂ ਵੀ ਬਹੁਤ ਲੰਬੀਆਂ ਸੀ ਪਰ ਅੱਜ ਕੱਲ੍ਹ ਹਰ ਕੋਈ ਰੋਜ਼ ਬਾਹਰ ਦਾ ਖਾਣਾ ਖਾਂਦੇ ਹਨ ਅਤੇ ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਸੀ ਪਹਿਲਾਂ ਲੋਕ ਬਹੁਤ ਤਕੜੇ ਹੁੰਦੇ ਸੀ ਪਰ ਅੱਜ ਕੱਲ੍ਹ ਦੇ ਜੁਆਕ ਤਕੜੇ ਨਹੀਂ ਹਨ ਉਹ ਬਿਲਕੁਲ ਲਿਫਾਫੇ ਹੀ ਬਣੇ ਹੋਏ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਰਹਿੰਦੀ ਹਨ ਅਤੇ ਬਾਹਰ ਦਾ ਖਾਣਾ ਖਾਣ ਨਾਲ਼ ਬਹੁਤ ਸਾਰੀਆਂ ਬਿਮਾਰੀਆਂ ਵੀ ਲੱਗਦੀਆਂ ਹਨ ਪਹਿਲਾਂ ਲੋਕਾਂ ਦਾ ਪਹਿ ਪਹਿਰਾਵਾ ਸੀ ਕਿ ਉਹ ਕੁੜਤਾ ਚਾਦਰਾ ਪਾਉਂਦੇ ਸੀ ਤੁਰਲਿਆਂ ਵਾਲ਼ੀ ਪੱਗ ਬੰਨ੍ਹਦੇ ਸੀ ਪਰ ਅੱਜ ਕੱਲ੍ਹ ਦੇ ਜਵਾਕ ਟੀ ਸ਼ਲਟਾਂ ਸ਼ਲਟ ਪੈਂਟਾਂ ਪਾਉਂਦੇ ਹਨ ਅਤੇ ਪਹਿਲਾਂ ਲੋਕ ਪੰਜਾਬੀ ਜੁੱਤੀ ਪਾਉਂਦੇ ਸੀ ਅਤੇ ਅੱਜ ਕੱਲ੍ਹ ਦੇ ਜਵਾਕ ਬੂਟ ਪਾਉਂਦੇ ਹਨ ਅਤੇ ਉਹ ਸਮਝਦੇ ਹਨ ਕਿ ਜੇਕਰ ਅਸੀਂ ਕੁੜਤਾ ਜਾਂ ਚਾਦਰਾ ਪਾਵਾਂਗੇ ਤਾਂ ਸਾਡੀ ਟੋਹਰ ਖਰਾਬ ਹੋਵੇਗੀ ਅਤੇ ਜੇਕਰ ਉਹ ਪੈਂਟ ਅਤੇ ਕਮੀਜ਼ ਪਾਣਗੇ ਤਾਂ ਉਨ੍ਹਾਂ ਦੀ ਟੋਹਰ ਬਣੀ ਰਹੇਗੀ ਪਹਿਲਾਂ ਪੁਰਾਣੀ ਪੀੜ੍ਹੀ ਵਿੱਚ ਲੋਕ ਰਾਤ ਨੂੰ ਬੈਠ ਕੇ ਗੱਲਾਂ ਕਰਦੇ ਸਨ ਵਿਹੜੇ ਵਿੱਚ ਬੈਠ ਕੇ ਬਾਤਾਂ ਪਾਉਂਦੇ ਸਨ ਪਰ ਅੱਜ ਕੱਲ੍ਹ ਹਰ ਕੋਈ ਆਪਣੇ ਫੋਨ 'ਤੇ ਲੱਗਿਆ ਰਹਿੰਦਾ ਹੈ ਕੋਈ ਕਿਸੇ ਨਾਲ਼ ਕੋਈ ਖਾਸ ਗੱਲ ਨਹੀਂ ਕਰਦਾ ਏ ਸਾਰਾ ਦਿਨ ਫੋਨ ਉਨ੍ਹਾਂ ਦੇ ਹੱਥ 'ਚ ਹੁੰਦਾ ਹੈ ਪਹਿਲਾਂ ਲੋਕ ਲੋਕੀਂ ਆਪਣੇ ਮਾਂ ਬਾਪ ਕੋਲ ਬੈਠ ਕੇ ਉਨ੍ਹਾਂ ਨਾਲ ਟਾਈਮ ਬਤੀਤ ਕਰਦੇ ਸਨ ਉਨ੍ਹਾਂ ਦੀਆਂ ਗੱਲਾਂ ਸੁਣਦੇ ਸਨ ਉਨ੍ਹਾਂ ਦੀ ਗੱਲਾਂ ਮੰਨਦੇ ਸਨ ਪਰ ਅੱਜ ਕੱਲ੍ਹ ਦੇ ਜਵਾਕ ਆਪਣੇ ਮਾਂ ਬਾਪ ਕੋਲ ਬੈਠਦੇ ਨਹੀਂ ਉਨ੍ਹਾਂ ਨਾਲ਼ ਕੋਈ ਵੀ ਟਾਈਮ ਬਤੀਤ ਨਹੀਂ ਕਰਦੇ ਹ ਹਰ ਟਾਈਮ ਫੋਨ 'ਤੇ ਲੱਗੇ ਰਹਿੰਦੇ ਹਨ ਹਰ ਟਾਈਮ ਫੋਨ 'ਤੇ ਗੇਮਾਂ ਖੇਡਦੇ ਰਹਿੰਦੇ ਹਨ ਅਤੇ ਆਪਣੇ ਮਾਂ ਬਾਪ ਦੀ ਇੰਨੀ ਕੋਈ ਖਾਸ ਗੱਲ ਨਹੀਂ ਮੰਨਦੇ